ਸਾਡੇ ਇਲਾਕੇ ਵਿੱਚ ਆਵਾਜਾਈ ਦੇ ਵੈਸੇ ਤਾਂ ਸਾਰੇ ਹੀ ਸਾਧਨ ਹਨ ਰੇਲ ਗੱਡੀ ਕਾਰ ਬੱਸ ਅਤੇ ਹਵਾਈ ਜਹਾਜ਼ ਪਰ ਸਾਡੇ ਇਲਾਕੇ ਦੇ ਵਿੱਚ ਜਿਹੜਾ ਰੇਲ ਗੱਡੀ ਦਾ ਸਾਧਨ ਹੈ ਉਸ ਨੂੰ ਅਤੇ ਬੱਸਾਂ ਦੇ ਸਾਧਨ ਨੂੰ ਦੋਵਾਂ ਨੂੰ ਹੀ ਸੁਧਾਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਅਜਿਹਾ ਰੂਟ ਹੈ ਜਿਹੜਾ ਕਿ ਅੱਗੇ ਜੰਮੂ ਕਸ਼ਮੀਰ ਨੂੰ ਵੀ ਜੋੜਦਾ ਹੈ ਅਤੇ ਦੂਸਰੇ ਤਰਫ ਰਾਜਸਥਾਨ ਤੱਕ ਜੋੜਦਾ ਹੈ ਪਰ ਇਸ ਰੂਟ ਦੇ ਉੱਤੇ ਬੱਸਾਂ ਦੇ ਵਿੱਚ ਜਿਹੜੀ ਰਸ਼ ਹੈ ਲੋਕਾਂ ਦਾ ਉਹ ਬਹੁਤ ਜ਼ਿਆਦਾ ਹੈ ਅਤੇ ਰੂਟ ਦੇ ਉੱਤੇ ਬੱਸਾਂ ਦੀ ਗਿਣਤੀ ਵੀ ਘੱਟ ਹੈ ਬੱਸਾਂ ਦੇ ਵਿੱਚ ਦਾ ਕਿਰਾਇਆ ਵੀ ਜ਼ਿਆਦਾ ਹੈ ਇਸ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਰੇਲ ਗੱਡੀ ਦਾ ਕਿਰਾਇਆ ਉੱਥੇ ਘੱਟ ਹੈ ਪਰ ਰੇਲ ਗੱਡੀ ਦੇ ਜਿਹੜਾ ਟਾਈਮ ਹੈ ਰੇਲ ਗੱਡੀ ਆਉਣ ਜਾਣ ਦਾ ਉਹ ਬਹੁਤ ਗਲਤ ਹੈ ਅੱਗੇ ਪਿੱਛੇ ਹੈ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਬੜੀ ਦਿੱਕਤ ਪ ਪਰੇਸ਼ਾਨੀ ਮਹਿਸੂਸ ਹੁੰਦੀ ਹੈ ਪਰ ਇਸ ਦੇ ਨਾਲ ਨਾਲ ਹੀ ਰੇਲ ਗੱਡੀ ਦੇ ਗੱਡੀਆਂ ਦੇ ਟਾਈਮ ਦੇ ਨਾਲ ਨਾਲ ਗੱਡੀਆਂ ਦੀ ਗਿਣਤੀ ਵੀ ਵਧਣੀ ਚਾਹੀਦੀ ਹੈ ਜਿਸ ਨਾਲ ਕਿ ਲੋਕਾਂ ਦੀ ਆਵਾਜਾਈ ਦੇ ਵਿੱਚ ਸਹੂਲਤ ਹੋ ਸਕੇ ਇਹ ਰੂਟ ਦੇ ਉੱਤੇ ਕਈ ਯਾਤਰਾਵਾਂ ਵੀ ਹੁੰਦੀਆਂ ਹਨ ਜਿਵੇਂ ਕਿ ਅਮਰਨਾਥ ਵੈਸ਼ਨੋ ਦੇਵੀ ਤਾਂ ਉਹਨਾਂ ਯਾਤਰਾਵਾਂ 'ਤੇ ਜਾਣ ਵਾਲੇ ਲੋਕਾਂ ਨੂੰ ਵੀ ਬੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜੇ ਉਹ ਲੋਕਾਂ ਨੂੰ ਭੀੜ ਭਾੜ ਦੇ ਵਿੱਚ ਖੜ੍ਹੇ ਹੋ ਕੇ ਕਿਉਂਕਿ ਸਮਾਂ ਬੜਾ ਲੰਬਾ ਹੈ ਅਤੇ ਉਸ ਸਮ ਲੰਬੇ ਸਮੇਂ ਚਾਰ ਪੰਜ ਘੰਟੇ ਲਈ ਉਹਨਾਂ ਲੋਕਾਂ ਨੂੰ ਖੜ੍ਹੇ ਹੋ ਕੇ ਜਾਣਾ ਪੈਂਦਾ ਹੈ ਜੋ ਕਿ ਉਹਨਾਂ ਨੂੰ ਬੜੀ ਦਿੱਕਤ ਪਰੇਸ਼ਾਨੀ ਕਰਦਾ ਹੈ